ਹੈਲੋ ਵੀਰ ਜੀ ਹਾਂਜੀ ਅੰਮ੍ਰਿਤਸਰ ਬਾਈਪਾਸ 'ਤੇ ਪਹੁੰਚ ਗਏ ਹੋ ਜੇ ਪਹੁੰਚ ਗਏ ਹੋ ਤਾਂ ਬਿਲਕੁਲ ਸਿੱਧਾ ਐਂਟਰ ਕਰ ਜਾਉ ਤਰਨ ਤਾਰਨ ਵਿੱਚ ਸਿੱਧਾ ਪੰਜ ਸੌ ਮੀਟਰ ਦੂਰੀ 'ਤੇ ਖੱਬੇ ਹੱਥ ਸ਼ਿਲਕੀ ਸਾਹਿਬ ਗੁਰਦੁਆਰਾ ਦਾ ਬੋਡ ਨਜ਼ਰ ਆਏਗਾ ਉਸ ਬੋਡ ਦੇ ਨਾਲ ਹੀ ਖੱਬੇ ਹੱਥ ਗਲੀ ਜਾਂਦੀ ਹੈ ਉਸ ਗਲੀ ਵਿੱਚ ਐਂਟਰ ਕਰ ਜਿਓ ਅਤੇ ਮੱਥੇ 'ਤੇ ਹੀ ਸ਼ਿਲਕੀ ਸਾਹਿਬ ਗੁਰਦੁਆਰਾ ਹੈ ਉਸ ਗੁਰਦੁਆਰੇ ਦੇ ਕੋਲ ਪਹੁੰਚ ਕੇ ਸੱਜੇ ਹੱਥ ਦੋ ਚਾਰ ਘਰ ਛੱਡ ਕੇ ਅਸੀਂ ਖੜ੍ਹੇ ਹੋਏ ਹਾਂ ਜੇ ਅਸੀਂ ਫਿਰ ਵੀ ਨਾ ਦਿਖੀਏ ਤਾਂ ਸਾਨੂੰ ਫਿਰ ਦੁਬਾਰਾ ਫੋਨ ਮਿਲਾ ਲਿਓ ਵੈਸੇ ਤਾਂ ਅਸੀਂ ਉੱਥੇ ਹੀ ਖੜ੍ਹੇ ਹਾਂ ਛੇਤੀ ਆ ਜਾਉ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਸਾਨੂੰ ਅੱਗੇ ਜਾਣ 'ਚ ਵੀ ਦੇਰੀ ਹੋ ਰਹੀ ਹੈ ਧੰਨਵਾਦ